ਹਾਂਜੀ ਹਾਂਜੀ ਮੈਂ ਵੀ ਬੱਸ ਦੀ ਵੇਟ ਕਰ ਰਿਹਾ ਬੜਾ ਚਿਰ ਹੋ ਗਿਆ ਖਲੋਤਿਆਂ ਨੂੰ ਬੱਸ ਹੀ ਨਹੀਂ ਆਉਣ ਡੀ

ਮੈਂ ਫਤਿਹਾਬਾਦ ਪਿੰਡ ਤੋਂ ਆ ਤੁਸ ਹਾਂ ਪਰ ਬੱਸਾਂ ਬੜੀਆਂ ਲ ਬੜੀਆਂ ਲੇਟ ਆਉਂਦੀਆਂ ਨੇ ਬੱਸਾਂ ਇੱਧਰੋਂ ਸਕੂਲੋਂ ਲੇਟ ਹੋਜੀ ਦਾ ਉੱਧਰੋਂ ਟਾਈਮ ਕਿੰਨਾ ਹੋ ਜਾਂਦਾ ਆਉਣ ਜਾਣ 'ਤੇ ਬਹੁਤ ਜ਼ਿਆਦਾ

ਹਮ ਬਿਲਕੁਲ ਨਾ ਨਾ ਰਫਤਾਰ ਹੀ ਬਹੁਤ ਸਲੋਅ ਜੀ ਸਵੇਰੇ ਜਾਓ ਤਾਂ ਲੇਟ ਸ਼ਾਮੀ ਤਾਂ ਲੇਟ ਸ਼ਾਮੀ ਘਰ ਪਹੁੰਚੀ ਦਾ ਸਵੇਰੇ ਸਕੂਲ ਤੋਂ ਲੇਟ ਹੋਜੀ ਦਾ ਇੰਨਾਂ ਮਤਲਬ ਉੱਧਰੋਂਂ ਸਕੂਲ ਲੱਗ ਜਾਂਦੇ ਇੱਥੇ ਬੱਸਾਂ ਵੇਟ ਕਰਦੇ ਕਰਦੇ ਆਪਾਂ ਕਿੰਨਾ ਟਾਈਮ ਹੋ ਜਾਂਦਾ ਸਾਨੂੰ ਬਹੁਤਾ ਬਹੁਤਾ ਹੀ ਹਾਂ ਹਾਂਜੀ ਹਾਂਜੀ ਹਾਂਜੀ ਨਾ ਨਾ ਨਾ ਉਹਦੇ ਫਿਰ ਉਹਨਾਂ ਨੂੰ ਵੀ ਕਈ ਵਾਰੀ ਕੰਪਲੇਂਟ ਪਾਈ ਦੀ ਕਈ ਵਾਰੀ ਸ਼ਿਕਾਇਤਾਂ ਕਰੀ ਦੀਆਂ ਮੁਹੱਲੇ ਨੂੰ ਵੀ ਪਰ ਕੋਈ ਵੀ ਇਹਨਾਂ ਦੇ ਅਸਰ ਕੋਈ ਹੈ ਹੀ ਨਹੀਂ ਫਿਰ ਵੀ ਉੱਦਾਂ ਦਾ ਉੱਦਾਂ ਹੀ ਹੈ ਜੇ ਚਲੋ ਆਉਂਦੇ ਆ ਬੱਸਾਂ ਆਉਂਦੀਆਂ ਹੈ ਅਤੇ ਉੱਤੋਂ ਖਚਾ ਖਚ ਭਰੀਆਂ ਹੁੰਦੀਆਂ ਨੇ ਨਾ ਬਹਿਣ ਨੂੰ ਸੀਟ ਮਿਲਦੀ ਏ ਨਾ ਕੁਛ ਹੋਰ ਅਤੇ ਬੜਾ ਹੀ ਬੁਰਾ ਹਾਲ ਹੈ ਨਾਲੇ ਚਲਾਉਂਦੇ ਵੀ ਫਿਰ ਹੌਲੀ ਹੌਲੀ ਚਲਾਉਂਦੇ ਵੀ ਚਲਾਉਂਦੇ ਵੀ ਹੌਲੀ ਹੌਲੀ ਆ ਅਤੇ ਹੋਰ ਟਾਈਮ ਮੈਨੂੰ ਤਾਂ ਲੇਟ ਹੋ ਸ਼ਾਮ ਪੈ ਜਾਂਦੀਆਂ ਛੇ ਵੱਜ ਜਾਂਦੇ ਬੰਦੇ ਨੇ ਹੋਰ ਵੀ ਕੰਮ ਕਰਨੇ ਹੁੰਦੇ ਘਰ ਜਾ ਕੇ ਇਹ ਪਰ ਹਾ ਨਾ ਨਾ ਇਹ ਨਹੀਂ ਹਟ ਇਹ ਚਲੋ ਜੀ ਆ ਮੇਰੀ ਵੀ ਆ ਗਈ ਜੇ ਚਲੋ ਅੱਛਾ ਠੀਕ ਹੈ ਜੀ ਓਕੇ ਬਾਏ